ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਸੀਂ ਕੌਣ ਅੱਛਾ ਜੀ ਦੱਸੋ ਨਾ ਠੀਕ ਹੈ ਜੀ ਦੁਕਾਨ ਤੁਹਾਨੂੰ ਕਿਸ ਪ੍ਰਪਸ ਲਈ ਚਾਹੀਦੀ ਹੈ ਦੇਖੋ ਜੀ ਤਿੰਨ ਦੁਕਾਨਾਂ ਖਾਲੀ ਪਈ ਇਕ ਰੂਮ ਹੈ ਉੱਪਰ ਚੱਲ ਜਾਊਗਾ ਦੁਕਾਨਾਂ ਦੇਖੋ ਜੀ ਅਸੀਂ ਰੂਮ ਤਾਂ ਹੈਗੇ ਦਸ ਬਾਏ ਬਾਰਾਂ ਦੇ ਰੂਮ ਦੁਕਾਨ ਥੱਲੇ ਹੁਣ ਤੁਸੀਂ ਦੇਖੋ ਤੁਹਾਡੀ ਰਿਕਵਾਇਰਮੈਂਟ ਇੰਨੇ ਦੀ ਸਰ ਜਾਊਗੀ ਨਹੀਂ ਸਰੂਗੀ ਦੇਖੋ ਜੀ ਹੁਣ ਜਦੋਂ ਆਪਾਂ ਵੀਹ ਹਜ਼ਾਰ ਰੁਪਏ ਪਰ ਮੰਥ ਦੇ ਰਹੇ ਹਾਂ ਤੁਸੀਂ ਜਿਸ ਤਰਾਂ ਤੁਸੀਂ ਤੁਹਾਨੂੰ ਨੰਬਰ ਦਿੱਤਾ ਰਾਮ ਸਿੰਘ ਨੇ ਨੰਬਰ ਦਿੱਤਾ ਹੋਇਆ ਤੁਸੀਂ ਖ਼ਾਸ ਬੰਦੇ ਆਪਣੇ ਤੁਸੀਂ ਅਠਾਰਾਂ ਹਜ਼ਾਰ ਰੁਪਏ ਦੇ ਦਿਓ ਸਾਨੂੰ ਹਾਂਜੀ ਅਤੇ ਇੱਕ ਰੈਂਟ ਐਗਰੀਮੈਂਟ ਮੈਨੂੰ ਨਹੀਂ ਨਹੀਂ ਮੇਨ ਰੋਡ 'ਤੇ ਹੀ ਆ ਜੀ ਅਤੇ ਇੱਕ ਰੈਂਟ ਐਗਰੀਮੈਂਟ ਬਣੂਗਾ ਦਸ ਪ੍ਰਸੈਂਟ ਹਰ ਸਾਲ ਰੈਂਟ ਵਧੂੰਗਾ ਦੇਖੋ ਜੀ ਸਕਿਉਰਟੀ ਜਾਊਂਗੀ ਇੱਕ ਲੱਖ ਰੁਪਏ ਹਾਂਜੀ ਅਤੇ ਉਹ ਸਕਿਉਰਟੀ ਰਿਫੰਡੇਬਲ ਹੋਊਂਗੀ ਜਦੋਂ ਤੁਸੀਂ ਲੀਵ ਕਰੋਗੇ ਅਤੇ ਉਸ ਹਾਂਜੀ ਉਹ ਤਾਂ ਨੋਟਰੀ ਅਟੈਸਟਿਡ ਕਰਵਾ ਲਿਓ ਤੁਸੀਂ ਕੋਰਟ 'ਤੇ ਜਾ ਕੇ ਚੱਲ ਪਾਊਂਗਾ ਮੈਂ ਤੁਹਾਡੇ ਨਾਲ ਤੁਸੀਂ ਮੈਨੂੰ ਕਹਿ ਦਿਓ ਜਦੋਂ ਤੁਸੀਂ ਆਉਣਾ ਇੱਕ ਵਾਰ ਤੁਸੀਂ ਦੇਖ ਲਓ ਆ ਕੇ ਦੁਕਾਨ ਦੇਖ ਲਓ ਸਟਾਫ ਮੈਡੀਕਲ ਚੱਲੋ ਜੀ ਮੈਡੀਕਲ ਸਟਾਫ ਚੱਲੋ ਇੱਕ ਮੇਰੇ ਦੋ ਚਾਰ ਮੇਰੇ ਨੋਨ ਤਾਂ ਹੈਗੇ ਉਸਦੇ ਉਹਨਾਂ ਨੂੰ ਪੁੱਛੇ ਸੈਲਰੀ ਕਿਆ ਦਿਉਂਗੇ ਤੁਸੀਂ ਉਸਦੀ ਅੱਛਾ ਖਾਣਾ ਪੀਣਾ ਵਿੱਚ ਹੋਵੇਗਾ ਅੱਡ ਹੋਊਂਗਾ ਅੱਛਾ ਜੀ ਅਤੇ ਡਿਊਟੀ ਡਿਊਟੀ ਅੱਠ ਘੰਟੇ ਦੀ ਹੋਊਗੀ ਨਾ ਜੀ ਤੁਹਾਨੂੰ ਐਕਚੁਅਲ ਦੇ ਚਾਰ ਕੁ ਬੰਦੇ ਚਾਹੀਦੇ ਨਾ ਐਗਜੈਕਟ ਮੈਂ ਜੇ ਚਲੋ ਮੈਂ ਕੋਈ ਨਹੀਂ ਪਤਾ ਕਰਵਾਉਂਦਾ ਜੇ ਮੇਰੇ ਨੋਨ ਤਾਂ ਵੈਸੇ ਮੇਰੇ ਨੋਨ ਤਾਂ ਹੈਗੇ ਹੈ ਹਾਂਜੀ

ਦੇਖੋ ਫੀਮੇਲ ਤਾਂ ਨਾਇਟ 'ਚ ਅਵੇਲੇਵਲ ਨਹੀਂ ਹੋਊਗੀ ਨਾ ਮੋਰਨਿੰਗ ਤਾਂ ਹੋ ਜਾਊਗੀ ਅੱਛਾ ਜੀ ਚੱਲੋ ਮੈਂ ਕੋਈ ਨਹੀਂ ਪਤਾ ਕਰਾਉਂਦਾ ਪੁੱਛ ਦੁਕਾਨ ਦਾ ਰੈਂਟ ਤੁਹਾਨੂੰ ਕਿਹਾ ਹੋਇਆ ਅਠਾਰਾਂ ਹਜ਼ਾਰ ਰੁਪਏ ਤੁਸੀਂ ਦੇ ਦਿਓ ਪਰ ਮੰਥ ਦਾ ਅਤੇ ਦਸ ਪਰਸੈਂਟ ਹਾਂਜੀ ਤਿੰਨ ਤਿੰਨ ਚੌਥਾ ਰੂਮ ਹੈ ਜੀ ਅਠਾਰਾਂ ਹਜ਼ਾਰ ਰੁਪਇਆ ਰੈਂਟ ਦੁਕਾਨ ਦਾ ਅਤੇ ਸੱਤ ਹਜ਼ਾਰ ਰੈਂਟ ਰੂਮ ਦਾ ਉੱਪਰ ਵਾਲੇ ਦਾ ਹਾਂਜੀ ਸੱਤਰ ਹਜ਼ਾਰ ਕਿਵੇਂ ਸਤਾ ਅਠਾਰਾਂ ਹਜ਼ਾਰ ਇਕ ਹੋ ਗਿਆ ਸੱਤ ਹਜ਼ਾਰ ਇੱਕ ਹੋ ਗਿਆ ਪੱਚੀ ਹਜ਼ਾਰ ਰੁਪਏ ਪੱਚੀ ਹਜ਼ਾਰ ਪਰ ਮਨਥ ਨਹੀਂ ਨਹੀਂ ਸਾਰੀ ਦੁਕਾਨਾਂ ਦਾ ਹਾਂਜੀ ਚੱਲੋ ਠੀਕ ਹੈ ਜੀ ਇਹ ਹੀ ਨੰਬਰ 'ਤੇ ਫੋਨ ਕਰ ਲਿਓ ਮੈਨੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਓਕੇ ਓਕੇ